ਇੱਕ ਜੂਨ ਦੋ ਹਜ਼ਾਰ ਤੇਈ ਪੰਜ ਜੁਲਾਈ ਦੋ ਹਜ਼ਾਰ ਤੇਈ ਸੱਤ ਅਗਸਤ ਦੋ ਹਜ਼ਾਰ ਤੇਈ ਨੌ ਅਕਤੂਬਰ ਦੋ ਹਜ਼ਾਰ ਤੇਈ ਦਸ ਅਕਤੂਬਰ ਦੋ ਹਜ਼ਾਰ ਤੇਈ